ਪੰਜਾਬ ਵਿੱਚ ਬਹੁਤ ਸਾਰੀਆਂ ਸਰਕਾਰ ਵੱਲੋਂ ਸਕੀਮਾਂ ਜਾਂ ਪ੍ਰੋਗਰਾਮ ਲਾਗੂ ਕੀਤੇ ਗਏ ਹਨ ਜਿਵੇਂ ਕਿ ਔਰਤਾਂ ਨੂੰ ਕੰਮਾਂ ਵਿੱਚ ਉਤਸ਼ਾਹ ਦੇਣ ਲਈ ਵਿਧਵਾ ਪੈਨਸ਼ਨ ਹੋ ਗਈ ਜਾਂ ਰੁਜ਼ਗਾਰ ਮਹਾਤਮਾ ਗਾਂਧੀ ਰੂਰਲ ਇੰਪਲੋਇਮੈਂਟ ਮਤਲਬ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਲਾਗੂ ਕੀਤੀਆਂ ਜਾਂਦੀਆਂ ਨੇ ਤਾਂ ਜੋ ਲੋਕਾਂ ਦਾ ਵਿਕਾਸ ਹੋ ਸਕੇ ਉਹਨਾਂ ਨੂੰ ਰੁਜ਼ਗਾਰ ਦੇ ਵੱਧ ਮੌਕੇ ਪ੍ਰਦਾਨ ਕੀਤੇ ਜਾ ਸਕਣ ਹਾਂ ਇਹਨਾਂ ਸਕੀਮਾਂ ਦਾ ਉਦੇਸ਼ ਲੋਕਾਂ ਨੂੰ ਲਾਭ ਪਹੁੰਚਾਉਣਾ ਹੈ ਪਰ ਕੀ ਇਹ ਲਾਭ ਸਭ ਨੂੰ ਇਕੁਅਲ ਰੂਪ ਵਿੱਚ ਮਿਲ ਰਿਹਾ ਹੈ ਨਹੀਂ ਮਿਲ ਰਿਹਾ ਕਿਉਂਕਿ ਜੇਕਰ ਮਹਾਤਮਾ ਗਾਂਧੀ ਦੀ ਰੂਰਲ ਇੰਪਲੋਇਮੈਂਟ ਸਕੀਮ ਗੱਲ ਕਰੀਏ ਤਾਂ ਉਹ ਸਾਲ ਵਿੱਚ ਇੱਕ ਪਰਟੀਕੁਲਰ ਸਮੇਂ ਦੇ ਵਿੱਚ ਆਈ ਕਾਂਟ ਸੇ ਸਾਲ ਸੌ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਕਰਾਉਂਦੀ ਹੈ ਪਰ ਕੀ ਤੁਹਾਨੂੰ ਕੀ ਪਤਾ ਜਿਹੜਾ ਇਕ ਸੌ ਇੱਕ ਵਾਲਾ ਇਨਸਾਨ ਹੈ ਉਸਨੂੰ ਇਹ ਸਕੀਮ ਦੀ ਪਹਿਲੇ ਜੋ ਸੌ ਲੋਕਾਂ ਨਾਲੋਂ ਜ਼ਿਆਦਾ ਲੋੜ ਹੋਵੇ ਤਾਂ ਜਿਹੜੀ ਇਹ ਸਕੀਮ ਹੈ ਉਸਨੂੰ ਜ਼ਰੂਰਤ ਦੇ ਪੱਧਰ 'ਤੇ ਲੋਕਾਂ ਨੂੰ ਜੋਬ ਓਪਰਚੁਨਟੀਸ ਪ੍ਰੋਵਾਈਡ ਕਰਵਾਉਣੀਆਂ ਚਾਹੀਦੀਆਂ ਹਨ